ਭਾਰਤ ਵਿੱਚ ਹਰ ਤਰ੍ਹਾਂ ਦਾ ਮੌਸਮ ਮੌਜੂਦ ਹੈ ਜਿਵੇਂ ਸਰਦ ਹੈ ਗਰਮ ਖੁਸ਼ਕ ਅਤੇ ਮੌਨਸੂਨ ਵੀ ਇੱਥੇ ਕਾਫ਼ੀ ਆਉਂਦੀਆਂ ਨੇ ਵੱਖ ਵੱਖ ਖੇਤਰ ਦੀ ਗੱਲ ਕਰੀਏ ਤਾਂ ਪੰਜਾਬ ਜਿਹੜਾ ਹੈ ਇਹਦੇ ਵਿੱਚ ਹਰ ਤਰ੍ਹਾਂ ਦੀ ਰੁੱਤ ਆਉਂਦੀ ਹੈ ਸਰਦੀਆਂ ਵੀ ਆਉਂਦੀ ਹੈ ਅਤੇ ਗਰਮੀਆਂ ਵੀ ਆਉਂਦੀਆਂ ਨੇ ਅਤੇ ਮਾਨਸੂਨ ਵੀ ਬਾਰਿਸ਼ ਵੀ ਆਉਂਦੀਆਂ ਨੇ ਹੋਰ ਖੇਤਰਾਂ ਦੀ ਗੱਲ ਕੀਤੀ ਜਾਵੇ ਤਾਂ ਰਾਜਸਥਾਨ ਥੋੜ੍ਹਾ ਖੁਸ਼ਕ ਰਹਿੰਦਾ ਹੈ ਉਹ ਰੇਤੀਲਾ ਖ ਖੇਤਰ ਹੋਣ ਕਰਕੇ ਥੋੜ੍ਹਾ ਖੁਸ਼ਕ ਹੈ ਅਤੇ ਮਹਾਰਾਸ਼ਟਰ ਪੂਨੇ ਜਿਹੜਾ ਹੈ ਉੱਥੇ ਨੋਰਮਲ ਹੀ ਮੌਸਮ ਰਹਿੰਦਾ ਹੈ ਜਿਵੇਂ ਬਾਰਿਸ਼ ਵਗੈਰਾ ਪੈਂਦੀ ਰਹਿੰਦੀ ਹੈ ਹੋਰ ਖੇਤਰਾਂ ਦੀ ਗੱਲ ਕਰੀਏ ਜੰਮੂ ਕਸ਼ਮੀਰ ਥੋੜ੍ਹਾ ਠੰਡਾ ਇਲਾਕਾ ਹੈ ਉੱਧਰ ਬਰਫ਼ ਜ਼ਿਆਦਾ ਪੈਂਦੀ ਅਤੇ ਪਹਾੜੀ ਏਰੀਏ ਦੀ ਗੱਲ ਕੀਤੀ ਜਾਵੇ ਹਿਮਾਚਲ ਸ਼ਿਮਲਾ ਜਿਹੜਾ ਹੈ ਉਹ ਵੀ ਬਰਫ਼ਬਾਰੀ ਉੱਥੇ ਹਮੇਸ਼ਾ ਪੈਂਦੀ ਰਹਿੰਦੀ ਹੈ ਇਸ ਤਰੀਕੇ ਗੱਲ ਕੀਤੀ ਜਾਵੇ ਹੋਰਨਾਂ ਸੂਬਿਆਂ ਦੀ ਅਸਾਮ ਦੀ ਉੱਥੇ ਵੀ ਮੌਨਸੂਨ ਕਾਫ਼ੀ ਆਉਂਦੀਆਂ ਨੇ ਇਸ ਕਰਕੇ ਭਾਰਤ ਜਿਹੜਾ ਹੈ ਇਹ ਵੱਖ ਵੱਖ ਜਿਹੜਾ ਇਹ ਮੌਸਮ ਹੈ ਇੱਥੇ ਹਰੇਕ ਖੇਤਰ ਦੇ ਵੱਖਰੇ ਵੱਖਰੇ ਮੌਸਮ ਨੇ